ਹਰ ਸੱਭਿਆਚਾਰ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਹਨ ਸਾਡੇ ਵੀ ਕਈ ਤਰ੍ਹਾਂ ਦੀਆਂ ਰਸਮਾਂ ਹੁੰਦੀਆਂ ਹਨ ਜਿਵੇ ਕਿ ਵਿਆਹ ਤੋਂ ਇੱਕ ਦਿਨ ਪਹਿਲਾਂ ਮਾਈਂਆ ਲੱਗਦਾ ਹੈ ਫਿਰ ਰਾਤ ਨੂੰ ਜਾਗੋ ਹੁੰਦੀ ਹੈ ਜਾਗੋ ਤੋਂ ਅਗਲੇ ਦਿਨ ਮੇਲ ਹੁੰਦਾ ਹੈ ਮੇਲ ਵਾਲੇ ਦਿਨ ਸਾਰੇ ਰਿਸ਼ਤੇਦਾਰ ਸੱਜਣ ਮਿੱਤਰ ਆਉਂਦੇ ਹਨ ਨਾਨਕੇ ਆਉਂਦੇ ਹਨ ਨਾਨਕੇ ਆਪਣਾ ਪ੍ਰੋਗਰਾਮ ਵਧੀਆ ਜਿਵੇਂ ਕਿ ਆਪਣਾ ਨਾਚ ਗਿੱਧਾ ਕਰਦੇ ਹਨ ਉਸਤੋਂ ਅਗਲੇ ਦਿਨ ਮੁੰਡਾ ਵਿਆਹ ਵਾਲਾ ਤਿਆਰ ਹੋ ਕੇ ਸਿਹਰੇ ਬੰਨ ਕੇ ਕੁੜੀ ਨੂੰ ਵਿਆਹੁਣ ਲਈ ਜਾਂਦਾ ਹੈ ਡੋਲੀ ਵਾਲੀ ਕਾਰ ਵਿੱਚ ਅਤੇ ਉਸਨੂੰ ਵਿਆਹ ਕੇ ਰੀਤੀ ਰਿਵਾਜ਼ ਰਸਮਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਘਰ ਲੈ ਕੇ ਆਉਂਦਾ ਹੈ